ਹਰ ਇੱਕ ਖੇਤਰ ਦੇ ਆਪਣੇ ਆਪਣੇ ਰਵਾਇਤੀ ਪਕਵਾਨ ਹੁੰਦੇ ਹਨ ਪਰ ਜੇਕਰ ਮੈਂ ਪੰਜਾਬ ਰਾਜ ਦੀ ਗੱਲ ਕਰਾਂ ਤਾਂ ਸਾਰੇ ਹੀ ਪੰਜਾਬ ਵਿੱਚ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਲੋਕ ਜ਼ਿਆਦਾ ਪਸੰਦ ਕਰਦੇ ਹਨ ਜੋ ਕਿ ਬਹੁਤ ਹੀ ਸਵਾਦ ਅਤੇ ਤੰਦਰੁਸਤੀ ਲਈ ਬਹੁਤ ਹੀ ਵਧੀਆ ਰਹਿੰਦਾ ਹੈ ਪਰ ਜੇਕਰ ਅੱਜ ਕੱਲ੍ਹ ਦੀ ਗੱਲ ਕੀਤੀ ਜਾਵੇ ਤਾਂ ਲੋਕ ਤਲ਼ੀਆਂ ਹੋਈਆਂ ਚੀਜ਼ਾਂ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਵੇਂ ਛੋਲੇ ਭਟੂਰੇ ਸਮੋਸੇ ਜਿਨ੍ਹਾਂ ਦਾ ਸੇਵਨ ਖਾਣ ਲਈ ਤਾਂ ਬਹੁਤ ਸਵਾਦਿਸ਼ਟ ਹੁੰਦਾ ਹੈ ਪਰ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ